ਮੈਂ ਬਹੁਤ ਲੰਬੀ ਦੌੜ ਵਿੱਚ ਹਿੱਸਾ ਲਿਆ ਅਤੇ ਇਸਦਾ ਅਨੁਭਵ ਬਹੁਤ ਚੰਗਾ ਸੀ ਅਤੇ ਮੈਂ ਇਸ ਦੀ ਤਿਆ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਸੀ ਮੈਰਾ ਥੋਨ ਦੌੜ ਵਿੱਚ ਅ ਪ੍ਰੈਕਟਿਸ ਕਰਦੇ ਰਹਿਣਾ ਚਾਹੀਦਾ ਹੈ ਅਤੇ ਅਭਿਆਸ ਇਸ ਵਿੱਚ ਅਭਿਆਸ ਬਹੁਤ ਜ਼ਰੂਰੀ ਹੈ ਅਭਿਆਸ ਵਾਰ ਵਾਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਜਦੋਂ ਵੀ ਸਮਾਂ ਮਿਲੇ ਅਭਿਆਸ ਕਰਨਾ ਚਾਹੀਦਾ ਹੈ ਮੈਂ ਇਸ ਦੀ ਤਿਆਰੀ ਵਧੀਆ ਤਰੀਕੇ ਨਾਲ ਕੀਤੀ ਅਤੇ ਜਦੋਂ ਵੀ ਸਮਾਂ ਮਿਲਦਾ ਸੀ ਮੈਂ ਅਭਿਆਸ ਕਰਦੀ ਰਹਿੰਦੀ ਸੀ ਅਤੇ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਅਤੇ ਦੌੜਨ ਲੱਗੇ ਬਹੁਤ ਤੇਜ਼ ਨਾਲ ਨਹੀਂ ਦੌੜਨਾ ਚਾਹੀਦਾ ਹੌਲੀ ਹੌਲੀ ਦੌੜਨਾ ਚਾਹੀਦਾ ਹੈ ਅਤੇ ਸਕਾ ਸਾਹ ਨੂੰ ਟਿਕਾਉਣਾ ਚਾਹੀਦਾ ਹੈ ਅਤੇ ਇਸ ਦੌੜਨ ਲੱਗੇ ਮੂੰਹ ਬੰਦ ਕਰਕੇ ਦੌੜਨਾ ਚਾਹੀਦਾ ਹੈ ਨਹੀਂ ਤਾਂ ਆਪਾਂ ਨੂੰ ਸਾਹ ਚੜ ਜਾਂਦਾ ਹੈ ਅਤੇ ਆਪਣੇ ਅਭਿਆਸ ਨਹੀਂ ਹੁੰਦਾ ਅਤੇ ਆਪਣੀ ਤਿਆਰੀ ਨਹੀਂ ਹੁੰਦੀ ਅਤੇ ਇੱਕੋ ਸਪੀਟ ਵਿੱ ਇੱਕ ਸਪੀਟ ਨਾਲ ਭੱਜਣਾ ਚਾਹੀਦਾ ਹੈ ਇੱਕ ਚਾਲ ਨਾਲ ਭੱਜਣਾ ਚਾਹੀਦਾ ਹੈ ਨਹੀਂ ਤਾਂ ਛੇਤੀ ਥੱਕ ਜਾਵਾਂਗੇ ਅਤੇ ਸਫ਼ਲਤਾ ਹਾਸਲ ਨਹੀਂ ਹੋਣੀ ਅਤੇ ਮੈਨੂੰ ਇਸ ਦੀ ਤਿਆਰੀ ਕਰਨ ਲੱਗੇ ਬਹੁਤ ਖੁਸ਼ੀ ਹੋਈ ਅਤੇ ਮੈਂ ਇਸਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕੀਤੀ